ਕਾਰ ਜੀਪ ਬੱਸ ਮਿਨੀ ਬੱਸ ਟਰੱਕ ਟੈਕਸੀ ਵੈਨ ਐਬੂਲੈਂਸ ਫਾਇਰ ਬ੍ਰਿਗੇਡ ਟਰੈਕਟਰ ਟ ਟਰਾਲੀ ਕਰੇਨ ਬਿਲਡੋਜਰ ਟਰੰਪ ਐਕਸਟੀਵੇਟਰ ਕੰਨ ਕੰਨਟੈਟਰ ਟਰੱਕ ਹਾਈਸਕ੍ਰੀਨ ਵੈਨ ਕੂੜਾ ਇਕੱਠਾ ਕਰਨ ਵਾਲਾ ਵਾਹਨ ਪੁਲਿਸ ਦੀ ਜੀਪ ਮਿਲਟਰੀ ਟਰੱਕ ਸਾਈਕਲ ਮੋਟਰਸਾਈਕਲ ਸਕੂਟਰ ਐਕਟਿਵਾ ਬੁਲੇਟ ਮੋਪੇਡ ਇਲੈਕਟਰਿਕ ਸਕੂਟੀ ਸਪੋਰਟਸ ਬਾਇਕ ਹਾਈਡਰੀ ਹਾਈਡ੍ਰਿਕ ਬਾਈਕ ਐਂਬੂਲੈਂਸ ਬਾਈਕ ਹਵਾਈ ਜਹਾਜ਼ ਹੈਲੀਕਾਪਟਰ ਗਲਾਈਡਰ ਡਰੋਨ ਪੈਸੈਂਜਰ ਜਹਾਜ਼ ਨੋਕਾ ਜਾਟ ਸਬਰੀਮ ਸਟੀਰਮ ਕੈਨੋ ਰੇਲਗੱਡੀ ਮੈਟਰੋ ਰੇਲ ਮਾਲ ਗੱਡੀ ਮੋਨੋਰੇਲ ਇਲੈਕਟ੍ਰਿਕ ਲੋਕੋਮੋਟਿਵ ਕੈ ਕੈਸ਼ ਵੈਨ ਸਨੋਮੋਬਾਈਲ ਗੋਲਫ ਕਾਟ ਆਇਲ ਟੈਂਕਰ ਗੈਸ ਟੈਂਕਰ ਫਾਰਲਿਫਟ ਮਿਡਨਾਈਟ ਰਿਸਕਿਊ ਵਾਹਨ ਐਮੋਜਮੈਂਟ ਪਾਰਕ ਰਾਈਡ ਫੂਡ ਟਰੱਕ ਕੈਰੇਵੈਨ ਬੁੱਲ ਗੱਡੀ ਘੋੜਾ ਗੱਡੀ ਰਿਕਸ਼ਾ ਤਾਂਗਾ ਹਾਥੀ ਗੱਡੀ ਊਠ ਗੱਡੀ ਇਲੈਕਟਰਿਕ ਕਾਰ ਸੈਲਫ ਡਰਾਈਵਿੰਗ ਕਾਰ ਸੋਲਰ ਕਾਰ ਫਾਇਰਿੰਗ ਕਾਰ ਮੈਗਲਿਵ ਟ੍ਰੇਨ ਸਪੇਸ ਬਸਟਲ ਰਾਕਟ ਹੋਲਡ ਕ੍ਰਾਫਟ ਹਾਈਪਰਲੂਮ ਧੰਨਵਾਦ